ਮੈਂ ਸਕੂਲ ਵਿੱਚ ਬਹੁਤ ਸਾਰੇ ਸੱਭਿਆਚਾਰਕ ਕਹਾਣੀਆਂ ਬਾਰੇ ਪੜ੍ਹਿਆ ਹੈ ਜਿਹਨਾਂ ਨੇ ਮੈਨੂੰ ਜੀਵਨ ਵਿੱਚ ਸਿੱਖਿਆਵਾਂ ਦਿੱਤੀਆਂ ਹਨ ਇਨ੍ਹਾਂ ਵਿੱਚ ਮੇਰੇ ਪੰਜਾਬੀ ਸੱਭਿਆਚਾਰ ਮਨਪਸੰਦ ਸੱਭਿਆਚਾਰ ਹੈ